ਹਾਂਜੀ ਨਮਸਕਾਰ ਜੀ ਕੋਣ ਬੋਲ ਰਹੇ ਹੋ ਜੀ ਹਾਂਜੀ ਹਾਂਜੀ ਪੇਂਟਰ ਬੋਲ ਰਿਹਾ ਜੀ ਮੈਂ ਰਾਹੁਲ ਪੇਂਟਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਉਹ ਤਾਂ ਆਉਂਦੀ ਆ ਜੀ

ਠੀਕ ਹੈ ਜੀ ਠੀਕ ਹੈ ਜੀ ਪਹਿਲੇ ਤਾਂ ਜੀ ਵਧਾਈਆਂ ਹੋਣ ਜੀ ਫਲੈਟ ਲੈਣ ਦੀਆਂ ਤੁਹਾਨੂੰ ਹਾਂਜੀ ਜੀ ਅਤੇ ਮੈਂ ਪੁੱਛਣਾ ਸੀ ਵੀ ਤੁਹਾਡਾ ਕਮਰੇ ਦਾ ਕਿੰਨਾ ਸਾਈਜ਼ ਹੈਗਾ ਮਕਾਨ ਦਾ ਕੀ ਸਾਈਜ਼ ਹੈ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਅੱਛਾ ਜੀ ਅੱਛਾ ਅੱਛਾ ਵਧੀਆ ਜੀ ਫਿਰ ਤਾਂ ਮਤਲਬ ਪੂਰਾ ਪ੍ਰੋਪਰ ਮਤਲਬ ਕਮਰਾ ਹੀ ਆ ਫਿਰ ਤਾਂ ਦੇਖੋ ਜੀ ਅੱਜ ਕੱਲ੍ਹ ਮੈਂ ਵੈਸੇ ਨਾ ਹਾਂਜੀ ਦੇਖੋ ਅੱਜ ਕੱਲ੍ਹ ਮੈਂ ਵੈਸੇ ਤਾਂ ਇੱਕ ਤਾਂ ਪੇਂਟ ਦਾ ਵੀ ਰਿਵਾਜ਼ ਹੈਗਾ ਹੈ ਵੈਸੇ ਮੈਂ ਨਹੀਂ ਕਹਿ ਰਿਹਾ ਕਿ ਚਲਾ ਗਿਆ ਅਤੇ ਪਰ ਡਾਉਨ ਸੀਲਿੰਗ ਦਾ ਜ਼ਿਆਦਾ ਰਿਵਾਜ ਆ ਅੱਜ ਕੱਲ੍ਹ ਅਤੇ ਤੁਸੀਂ ਅੱਛਾ ਗੋਲ 'ਤੇ ਕਰਵਾਉਣੀ ਆ ਮਤਲਬ ਜਿਹੜੀ ਆ

ਹਾਂਜੀ ਕਲਰ ਦੇਖੋ ਕਲਰ ਤਾਂ ਜੀ ਅੱਜ ਕੱਲ੍ਹ ਨਾ ਕਲਰ ਫਿਰ ਕੰਬੀਨੇਸ਼ਨ ਚੱਲ ਰਿਹਾ ਜੀ ਅੱਜ ਕੱਲ੍ਹ ਜਿਵੇਂ ਨਾ ਕਿ ਮੰਨ ਕੇ ਚੱਲੋ ਨਾ ਪੂਰੇ ਕਮਰੇ 'ਚ ਇੱਕ ਹੀ ਕਲਰ ਨਹੀਂ ਹੋਵੇਗਾ ਜਿਵੇਂ ਸਾਹਮਣੇ ਵਾਲੀ ਦੀਵਾਰ 'ਚ ਅਲੱਗ ਕਮਰ ਅਲੱਗ ਕਲਰ ਹੋਵੇਗਾ ਉਹ ਸਾਹਮਣੇ ਵਾਲੀ ਅਲੱਗ ਹੋ ਜੇਗਾ ਕਬੀਨੇਸ਼ਨ ਮਤਲਬ ਬੀ ਭੈੜਾ ਵੀ ਨਾ ਲੱਗੇ ਅਤੇ ਥੋੜ੍ਹਾ ਵਧੀਆ ਲੱਗੇ ਮਤਲਬ ਕਬੀਨੇਸ਼ਨ ਬਣ ਜਾਵੇਗਾ ਅਲੱਗ ਦੀਵਾਰ 'ਤੇ ਅਲੱਗ ਅਲੱਗ ਹੋਵੇਗਾ ਅੱਜ ਕੱਲ੍ਹ ਤਾਂ ਇਹ ਹੀ ਚੱਲ ਰਿਹਾ ਵੈਸੇ ਬਾਕੀ ਤੁਹਾਡੀ ਇੱਛਾ ਜਿਵੇਂ ਵੀ ਤੁਸੀਂ ਕਹੋਗੇ ਡਿਜਾਇਨਿੰਗ ਹਾਂ ਜਿਵੇਂ ਵੋਲਪੇਪਰ ਟਾਈਪ ਚਾਹੀਦੀ ਹੈ ਜਾਂ ਮੈਨੂੰ ਥੋੜ੍ਹੀ ਕੋਈ ਹੈਂਡ ਹੈਂਡ ਮਤਲਬ ਜਿਹੜੀ ਹੈਂਡ ਕਰਾਫਟ ਹੁੰਦਾ ਕਹਿਣ ਦਾ ਮਤਲਬ ਹੱਥ ਨਾਲ ਜਿਹੜੀ ਕਲਾਕ੍ਰਿਤੀ ਜਿਹੀ ਉਵੇਂ ਦੀ ਚਾਹੀਦੀ ਹੈ ਹਾਂ ਉਹ ਤਾਂ ਤੁਹਾਡੀ ਉੱਥੇ ਹੀ ਹਾਂ ਹਾਂਜੀ ਹਾਂਜੀ ਨਹੀਂ ਉਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਹਾਂਜੀ ਇੱਕ ਤਾਂ ਸਿਰਫ ਹਾਂਜੀ ਹਾਂਜੀ ਹੁੰ ਉਹ ਤਾਂ ਹੈ ਜੀ ਹਾਂਜੀ ਹਾਂਜੀ ਹੁੰ ਹਾਂਜੀ ਹਾਂਜੀ ਇੱਕ ਐਂ ਕਰਾਂਗੇ ਜੀ ਅੱਜ ਕੱਲ੍ਹ ਸਿੰਪਲ ਵਾਲੀ ਕਰ ਦੇਵਾਂਗੇ ਜੀ ਸਿੰਪਲ ਵਾਲੀ ਇੱਕ ਤਾਂ ਸੋਹਣੀ ਵੀ ਲੱਗੂਗੀ ਜੀ ਸਿੰਪਲ ਐਂਡ ਸੋਬਰ ਬਿਲਕੁਲ ਠੀਕ ਹੈ ਜੀ ਅਤੇ ਇੱਕ ਤਾਂ ਉਹਦੇ ਪੈਸੇ ਵੀ ਘੱਟ ਹੋਣਗੇ ਹਾਂਜੀ ਨਹੀਂ ਵਾਈਟ ਵੂਇਟ ਤਾਂ ਨਹੀਂ ਵਾਈਟ ਦਾ ਤਾਂ ਫਿਰ ਚੱਲਣਾ ਵਾਈਟ ਤਾਂ ਤੁਹਾਨੂੰ ਐਂ ਲੱਗੇਗਾ ਜਿਵੇਂ ਬਿਰਲਾ ਪੁੱਟੀ ਕਰਵਾਈ ਹੈ ਸਿਰਫ ਲਗੇਗਾ ਹੀ ਨਹੀਂ ਪੇਂਟ ਕਰਵਾਇਆ ਪੈਸੇ ਵੀ ਲਾ ਬੈਠੋਗੇ ਅਤੇ ਲੋਕ ਲੋਕਾਂ ਨੇ ਕਹਿਣਾ ਇਹ ਤਾਂ ਕੁਛ ਕਰਵਾਇਆ ਹੀ ਨਹੀਂ ਹਾਂ ਕੁਆਲਿਟੀ ਹਾਂਜੀ ਹਾਂਜੀ ਜਿਹੜੀ ਹੈ ਮਤਲਬ ਹਾਂ ਉਹ ਭਾਈ ਜੀ ਥੋੜ੍ਹਾ ਲੰਬਾ ਚੱਲ ਜਾਂਦਾ ਹਾਂਜੀ ਹਾਂਜੀ ਨਹੀਂ ਕੋਈ ਨਹੀਂ ਜੀ ਆਪਾਂ ਕਰ ਦੇਵਾਂਗੇ ਜੀ ਡਾਊਨ ਸੀਲਿੰਗ ਵੀ ਕਰ ਦੇਵਾਂਗੇ ਜੀ ਤੁਸੀਂ ਡਾਊਨ ਸੀਲਿੰਗ ਜਿਹੜੇ ਜਿਹੜੇ ਕਮਰੇ 'ਚ ਕਹੋਗੇ ਓਧਰ ਪਤਾ ਜੀ ਕੀ ਵੇਖ ਕੇ ਪਤਾ ਲੱਗੇਗਾ ਜੀ ਇਹ ਆਪਾਂ ਐਂ ਕਰਾਂਗੇ ਤੁਸੀਂ ਮੈਨੂੰ ਐਡਰਸ ਉਡਰੈੱਸ ਦੱਸ ਦਿਓ ਆਪਾਂ ਆ ਕੇ ਬੈਠ ਕੇ ਗੱਲ ਕਰ ਲਾਵਾਂਗੇ ਅਤੇ ਰੇਟ ਆਪਾਂ ਜਾਇਜ਼ ਹੀ ਲਾਵਾਂਗੇ ਸਕੇਅਰ ਫੂਟ ਦੇ ਹਿਸਾਬ ਨਾਲ ਰੇਟ ਹੁੰਦਾ ਜੀ ਪਹਿਲੀ ਗੱਲ ਤਾਂ ਇਹ ਹੈ ਜੀ ਹਾਂ ਜੀ ਤੁਸੀਂ ਮੈਨੂੰ ਨਾ ਇਸ ਨੰਬਰ 'ਤੇ ਨਾ ਜਿਵੇਂ ਕਹੋਂਗੇ ਆਪਾਂ ਉਵੇਂ ਕਰ ਦੇਵਾਂਗੇ ਜਿੰਨੇ ਟਾਈਮ 'ਚ ਕਹੋਂਗੇ ਉਵੇਂ ਕਰ ਦੇਵਾਂਗੇ ਠੀਕ ਹੈ ਜੀ ਕੋਈ ਹੋਰ ਦਿੱਕਤ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹੋਰ ਜੀ ਕੋਈ ਸੇਵਾ ਠੀਕ ਹੈ ਜੀ